ਵੀਹ ਦਸੰਬਰ ਉੱਨੀ ਸੌ ਅੱਸੀ ਤੇਰ੍ਹਾਂ ਅਪ੍ਰੈਲ ਉੱਨੀ ਸੌ ਉੱਨੀ ਤੇਈ ਮਾਰਚ ਉੱਨੀ ਸੌ ਸੋਲ੍ਹਾਂ ਇੱਕੀ ਮਾਰਚ ਉੱਨੀ ਸੌ ਛਿਆਨਵੇਂ ਸਤਾਰ੍ਹਾਂ ਜੁਲਾਈ ਦੋ ਹਜ਼ਾਰ ਵੀਹ